ਜੀ ਹਾਂ ਮੈਂ ਛੋਟੇ ਹੁੰਦੇ ਸਕੂਲ ਦੇ ਵਿੱਚ ਸਾਡੇ ਗੇਮਾਂ ਹੁੰਦੀਆਂ ਸੀ ਜਿਸ ਵਿੱਚ ਅਸੀਂ ਦੌੜ ਭੱਜ ਵਾਲੀਆਂ ਗੇਮਾਂ ਵਿੱਚ ਅਸੀਂ ਹਿੱਸਾ ਲ ਲਿਆ ਕਰਦੇ ਸੀ ਅਤੇ ਮੈਂ ਸਵੇਰੇ ਉੱਠ ਕੇ ਵੀ ਗਰਾਊਡ ਵਿੱਚ ਜਾ ਕੇ ਦੌੜਦਾ ਹੁੰਦਾ ਸੀ ਜਿਵੇਂ ਕਿ ਚਾਰ ਸੌ ਮੀਟਰ ਦੇ ਪੰਜ ਗੇੜੇ ਲਗਾਉਣੇ ਅਤੇ ਜਾ ਕੇ ਸਕੂਲ ਵਿੱਚ ਦੁਬਾਰਾ ਤੋਂ ਉਸੇ ਚੀਜ਼ ਦੀ ਪ੍ਰੈਕਟਿਸ ਕਰਨੀ ਜਿਸ ਨਾਲ਼ ਬਹੁਤ ਜ਼ਿਆਦਾ ਸਟੈਮਿਨਾ ਬਹੁਤ ਜ਼ਿਆਦਾ ਵੱਧਦਾ ਹੈ ਜ਼ਿਆਦਾਤਰ ਸਿਹਤ ਠੀਕ ਰਹਿੰਦੀ ਹੈ ਅਤੇ ਬਿਮਾਰੀਆਂ ਤੋਂ ਦੂਰ ਹੋ ਹੋ ਜਾਂਦਾ ਬੰਦਾ ਇਸ ਲਈ ਸਾਨੂੰ ਦੌੜਨ ਭੱਜਣ ਵਾਲੀਆਂ ਗੇਮਾਂ 'ਚ ਹਿੱਸਾ ਲੈਣਾ 'ਚ ਲੈਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਦੌੜ ਭੱਜਣ ਵਾਲੀਆਂ ਗੇਮਾਂ ਵੱਲ ਉਤ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਜੋ ਬੱਚੇ ਹੈ ਜ਼ਿਆਦਾਤਰ ਮੋਬਾਈਲਾਂ ਵਿੱਚ ਲੱਗੇ ਰਹਿੰਦੇ ਹੈ ਅਤੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਹੈ ਅਤੇ ਉਹ ਆਪਣੀਆਂ ਸਿਹਤ ਸਿਹਤ ਵੀ ਖ਼ਰਾਬ ਕਰਦੇ ਹੈ ਇਸ ਲਈ ਸਾਨੂੰ ਦੌ ਤੇਜ਼ ਦੌੜਨ ਵਾਲੀਆਂ ਜਿਹੜੀਆਂ ਗੇਮਜ਼ ਨੇ ਉਹਨਾਂ ਵਿੱਚ ਜਾ ਕੇ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ